ਹੈਲੋ ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਤੁਹਾਤੋਂ ਸੋਫਾ ਮੰਗਵਾਇਆ ਹੈ ਇਹ ਤਾਂ ਮੇਰੇ ਬਿਲਕੁਲ ਪਸੰਦ ਨਹੀਂ ਜਿਹ ਜਿਹੜਾ ਮੈਂ ਰੰਗ ਤੁਹਾਨੂੰ ਦੱਸਿਆ ਜੀ ਉਹ ਰੰਗ ਹੀ ਹੈ ਨਹੀਂ ਨੰਬਰ ਦੋ 'ਤੇ ਜਿਹੜੇ ਇਹਦੇ ਸਪਰਿੰਗ ਹੈ ਅਤੇ ਇਹ ਤਾਂ ਹੁਣੇ ਹੀ ਆਉਂਦੇ ਸਾਰ ਹੀ ਬਹਿ ਗਏ ਨੰਬਰ ਤਿੰਨ 'ਤੇ ਜਿਹੜਾ ਕੱਪੜਾ ਹੈ ਉਹ ਵੀ ਬਹੁਤ ਘਟੀਆ ਲਾਇਆ ਨੰਬਰ ਚਾਰ 'ਤੇ ਲੱਕੜੀ ਤਾਂ ਇੱਦਾਂ ਦੀ ਲੱਗਦੀ ਹੈ ਜਿਵੇਂ ਇਹਨੂੰ ਹੁਣੇ ਹੀ ਘੋਣਾ ਲੱਗ ਜਾਵੇ ਅਤੇ ਨਾ ਹੀ ਮੇਰੇ ਪਰਿਵਾਰ ਦੇ ਪਸੰਦ ਹੈ ਅਤੇ ਕੀਮਤ ਦੇ ਹਿਸਾਬ ਨਾਲ ਮੈਨੂੰ ਬਹੁਤ ਮਹਿੰਗਾ ਲੱਗਿਆ ਅਤੇ ਜਦੋਂ ਮੈਂ ਤੁਹਾਡੇ ਸੋਫੇ ਲਿਆਉਣ ਤੋਂ ਬਾਅਦ ਮਾਰਕੀਟ ਦੇ ਵਿੱਚ ਪਤਾ ਕਰਿਆ ਅਤੇ ਉਹਦੇ ਰੇਟ ਦਾ ਅਤੇ ਤੁਹਾਡੇ ਰੇਟ ਦਾ ਬਹੁਤ ਲਗਭਗ ਦੁੱਗਣੇ ਦਾ ਫਰਕ ਹੈ ਇਸ ਕਰਕੇ ਇਹ ਤੁਸੀਂ ਆਪਣਾ ਜਿਹੜਾ ਸੋਫਾ ਹੈ ਉਹ ਤੋਂ ਬਾਅਦ ਜਿਹੜਾ ਡਿਲੀਵਰੀ ਕਰਨ ਆਇਆ ਤਾ ਉਹ ਵੀ ਸਾਤੋਂ ਪੈਸੇ ਭਾਲਦਾ ਸੀ ਕਹਿੰਦਾ ਜੀ ਮੈਨੂੰ ਤ ਤੁਹਾਤੋਂ ਪੈਸੇ ਲੈਣੇ ਮੈਂ ਤੁਹਾਡਾ ਸੋਫਾ ਲੈ ਕੇ ਆਇਆ ਅਤੇ ਉਹ ਤਾਂ ਆਪਣੀ ਗੱਲ ਪਹਿਲਾਂ ਹੀ ਹੋਈ ਤੀ ਬੀ ਬੀ ਇਹ ਤੋਂ ਬਾਅਦ ਫਾਲਤੂ ਪੈਸਾ ਨਹੀਂ ਲੈਣਾ ਹੁਣ ਤੁਹਾਨੂੰ ਇੱਕੋ ਹੀ ਬੇਨਤੀ ਹੈ ਵੀ ਇਹ ਆਪਣਾ ਸੋਫਾ ਜਾਂ ਤਾਂ ਵਾਪਸ ਲੈ ਜੋ ਮੈਨੂੰ ਪੈਸੇ ਵਾਪਸ ਕਰ ਦਿਉ ਜਾਂ ਬਈ ਜਿਹੜਾ ਸੋਫਾ ਮੈਂ ਮੰਗਾਇਆ ਸੀ ਉਸ ਮੈਨੂੰ ਭੇਜ ਦਿਉ ਤੁਹਾਡਾ ਬਹੁਤ ਬਹੁਤ ਧੰਨਵਾਦ